ਇਕ ਜਨਵਰੀ ਦੋ ਹਜ਼ਾਰ ਇੱਕੀ ਚਾਰ ਫਰਵਰੀ ਦੋ ਹਜ਼ਾਰ ਬਾਈ ਛੇ ਜੂਨ ਦੋ ਹਜ਼ਾਰ ਤੇਈ ਸੱਤ ਅਪ੍ਰੈਲ ਦੇ ਹਜ਼ਾਰ ਇੱਕੀ ਅੱਠ ਜੂਨ ਦੋ ਹਜ਼ਾਰ ਬਾਈ